ਹਾਂਜੀ ਮੈਂ ਸ਼ੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹਾਂ ਅਤੇ ਆਪਣਾ ਮੈਂ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਬਣਾਇਆ ਹੋਇਆ ਹੈ ਉਹਦੇ 'ਤੇ ਮੈਂ ਆਪਣੀਆਂ ਤਸਵੀਰਾਂ ਪੋਸਟ ਕਰਦੀ ਹਾਂ ਅਤੇ ਇਹ ਸਭ ਕੁਛ ਮੈਨੂੰ ਬਹੁਤ ਵਧੀਆ ਲੱਗਦਾ ਹੈ ਸ਼ੋਸ਼ਲ ਮੀਡੀਆ ਨੂੰ ਯੂਜ਼ ਕਰਨਾ ਅਤੇ ਸ਼ੋਸ਼ਲ ਮੀਡੀਆ ਸਾਡੀ ਇੱਕ ਡੇਲੀ ਲਾਈਫ ਨੂੰ ਪ੍ਰਮੋਟ ਕਰਦਾ ਸਾਡੀ ਡੇਲੀ ਰੁਟੀਨ ਸ਼ੋਅ ਹੁੰਦੀ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਸਾਡੀ ਪਹਿਚਾਣ ਵੱਧਦੀ ਆ ਅਸੀਂ ਆਰਟਿਸਟ ਨੂੰ ਦੇਖਦੇ ਹਾਂ ਤੁਹਾਨੂੰ ਦੱਸ ਦੇਈਏ ਕਿ ਜੇ ਉਹ ਇੰਸਟਾਗ੍ਰਾਮ ਉਹ ਬਹੁਤ ਵਧੀਆ ਇੱਕ ਸ਼ੋਸ਼ਲ ਅਕਾਊਂਟ ਆ ਜਿੱਥੇ ਅਸੀਂ ਆਪਣੇ ਆਪ ਨੂੰ ਸ਼ੋਅ ਕਰ ਸਕਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਆਰਟਿਸਟ ਇੱਥੋਂ ਪੈਸਾ ਵੀ ਕਮਾ ਰਹੇ ਨੇ ਉਹ ਆਪਣੀ ਇੱਕ ਇੱਕ ਪੋਸਟ ਦਾ ਲੱਖਾਂ ਦੇ ਵਿੱਚ ਪੈਸਾ ਲੈ ਰਹੇ ਨੇ ਅਤੇ ਇਸੇ ਤਰ੍ਹਾਂ ਅਸੀਂ ਵੀ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਆਪ ਨੂੰ ਪ੍ਰਮੋਟ ਕਰ ਸਕਦੇ ਹਾਂ ਇੱਕ ਵਧੀਆ ਪਹਿਚਾਣ ਬਣਾ ਸਕਦੇ ਹਾਂ ਅਤੇ ਇਸ ਤੋਂ ਜ਼ਰੀਏ ਇੱਕ ਇੱਕ ਵਧੀਆ ਇਨਕਮ ਸੋਰਸ ਪੈਦਾ ਲੈ ਕਰ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜੇ ਅਸੀਂ ਕਿਸੇ ਵਰਕ ਨੂੰ ਪ੍ਰਮੋਟ ਕਰਨਾ ਹੋਵੇ ਲੋਕਾਂ ਤੱਕ ਦੱਸਣਾ ਹੋਵੇ ਕਿ ਅਸੀਂ ਕੋਈ ਸਪੈਸ਼ਲ ਚੀਜ਼ ਕਰਦੇ ਹਾਂ ਤਾਂ ਉਸਨੂੰ ਅਸੀਂ ਪ੍ਰਮੋਟ ਕਰ ਸਕਦੇ ਹਾਂ ਇਹਦੇ ਨਾਲ਼ ਲੋਕਾਂ ਵੱਧ ਤੋਂ ਵੱਧ ਲੋਕਾਂ ਤੱਕ ਜੋ ਸਾਡੀ ਜਾਣਕਾਰੀ ਆ ਉਹ ਪੁੱਜਦੀ ਆ ਅਤੇ ਇਹਦੇ ਨਾਲ਼ ਸਾਨੂੰ ਇੱਕ ਨਵੀਂ ਪਹਿਚਾਣ ਮਿਲਦੀ ਆ